ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਠੀਕ ਹੈ ਜੀ ਮੈਂ ਤੁਹਾਨੂੰ ਪੁੱਛਣਾ ਸੀ ਭਤੀਜੇ ਦੀ ਐਡਮਿਸ਼ਨ ਕਰਵਾਉਣੀ ਸੀ ਪਟਿਆਲੇ 'ਚ ਕੋਈ ਬੈਸਟ ਸਕੂਲ ਹੋਏਗਾ ਕਿਹੜੇ ਕਿਹੜੇ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ

ਜੀ ਠੀਕ ਹੈ ਹਾਂ ਹਾਂਜੀ

ਠੀਕ ਹੈ ਬੁੱਢਾ ਦਲ ਦੀ ਟਾਈਮਿੰਗ ਸਕੂਲ ਦੀ ਕਿੰਨੀ ਤੇ ਹੈ ਬੁੱਢਾ ਦਲ ਸਕੂਲ ਦੀ ਟਾਈਮਿੰਗ ਵਗੈਰਾ ਠੀਕ ਹੈ ਠੀਕ ਹੈ ਓਕੇ ਥੈਂਕ ਯੂ